ਹਾਂਜੀ ਜੋ ਆਪਣਾ ਪੰਜਾਬ ਭਾਰਤ ਦਾ ਸੱਭਿਆਚਾਰ ਹੈ ਬਹੁਤ ਜ਼ਿਆਦਾ ਵਧੀਆ ਖਾਸ ਤੌਰ 'ਤੇ ਪੰਜਾਬ ਦਾ ਜੋ ਪਹਿਰਾਵਾ ਹੈਗਾ ਭਾਰਤ ਦੇ ਜੋ ਸੱਭਿਆਚਾਰ ਬਾਰੇ ਦੱਸੀਏ ਤਾਂ ਜਿਹੜੀਆਂ ਕਿ ਔਰਤਾਂ ਨੇ ਉਹ ਜ਼ਿਆਦਾਤਰ ਪੰਜਾਬੀ ਸਲਵਾਰ ਸੂਟ ਪਾਉਂਦੀਆਂ ਨੇ ਔਰ ਜਿਹੜੇ ਕਿ ਮੰਨ ਕੇ ਚਲੋ ਵੀ ਜੈਂਟਸ ਨੇ ਉਹਨਾਂ ਦੇ ਜ਼ਿਆਦਾਤਰ ਕੁੜਤਾ ਪਜਾਮਾ ਪਾਇਆ ਹੁੰਦਾ ਹੈਗਾ ਬਜ਼ੁਰਗ ਜਿਹੜੇ ਹੈਗੇ ਆ ਆਪਣੇ ਭਾਰਤ ਦੇ ਉਹਨਾਂ ਦੇ ਸਭ ਤੋਂ ਜ਼ਿਆਦਾ ਕੁੜਤੇ ਨਾਲ ਚਾਦਰਾ ਪਾਇਆ ਹੁੰਦਾ ਹੈਗਾ ਅਤੇ ਜਿਹੜੀਆਂ ਕਿ ਕਈ ਵਾਰੀ ਕੋਈ ਫੰਕਸ਼ਨ ਹੁੰਦੇ ਹਨ ਅਤੇ ਹੈ ਨਾ ਜਿਹੜੀਆਂ ਆਪਣੀਆਂ ਲੇਡੀਜ ਔਰਤਾਂ ਨੇ ਉਹ ਜ਼ਿਆਦਾਤਰ ਕੁੜਤੇ ਘੱਗਰਿਆਂ ਨਾਲ ਜਿਹੜਾ ਕਿ ਆਪਣੇ ਰੂਪ ਨੂੰ ਸ਼ਿੰਗਾਰ ਦੀਆਂ ਨੇ ਫੰਕਸ਼ਨਾਂ ਦੇ ਵਿੱਚ ਤਾਂ ਉਹ ਸਭ ਤੋਂ ਵਧੀਆ ਲੱਗਦਾ ਹੈਗਾ ਹੋਰ ਸਭੈ ਹੋਰ ਦੇਸ਼ਾਂ 'ਚ ਜ਼ਿਆਦਾ ਜਿਵੇਂ ਕਿ ਬਾਕੀ ਦੇਸ਼ਾਂ ਦੇ ਲੋਕ ਵੀ ਆ ਉਹ ਵੀ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਨੂੰ ਹੀ ਅਪਣਾਉਂਦੇ ਹੈਗੇ ਆ ਜੋ ਤਾਂ ਕਿ ਉੱਧਰ ਵੀ ਪੰਜਾਬੀ ਸੂਟ ਪਾਏ ਜਾਂਦੇ ਆ ਜੋ ਕਿ ਉਦ ਬਾਹਰਲੇ ਦੇਸ਼ਾਂ ਦੇ ਲੋਕ ਵੀ ਭਾਰਤ ਦੇ ਸੱਭਿਆਚਾਰ ਨੂੰ ਮੰਨਦੇ ਹੈਗੇ ਆ ਉਹਨਾਂ ਦੇ ਜੋ ਕਿ ਪੰਜਾਬੀ ਸੂਟ ਸੂਟ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈਗੀ ਜਿਵੇਂ ਕਿ ਕਈ ਫੰਕਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਔਰਤਾਂ ਗਿੱਧਾ ਭੰਗੜਾ ਕਰਦੇ ਨੇ ਹੈ ਨਾ ਜੈਂਟਸ ਹੁੰਦੇ ਨੇ ਤਾਂ ਸਭ ਤੋਂ ਬੈਸਟ ਮੈਨੂੰ ਲੱਗਦਾ ਹੈਗਾ ਕਿ ਭਾਰਤ ਦਾ ਸੱਭਿਆਚਾਰ ਹੀ ਸਭ ਤੋਂ ਬੈਸਟ ਹੈ